ਮੇਰੇ ਕੋੋਲ ਇੱਕ ਕੁਆਰਟਜ਼ ਦੀ ਸਮਾਰਟ ਵਾਚ ਹੈ ਜੋ ਕਿ ਮੇਰੇ ਦੋਸਤ ਨੇ ਮੈਨੂੰ ਮੇਰੇ ਜਨਮ ਦਿਨ ਵਾਲੇ ਦਿਨ ਮੈਨੂੰ ਗਿਫ਼ਟ 'ਚ ਦਿੱਤੀ ਸੀ ਅਤੇ ਇਹ ਸਮਾਰਟ ਵਾਚ ਮੇਰੇ ਮਿੱਤਰ ਨੇ ਮੈਨੂੰ ਕਰੀਬ ਤਿੰਨ ਕੁ ਸਾਲ ਪਹਿਲਾਂ ਦਿੱਤੀ ਸੀ ਅਤੇ ਤਿੰਨ ਕੁ ਸਾਲ ਪਹਿਲਾਂ ਵੀ ਜੋ ਇਸ ਦੀ ਕੰਡੀਸ਼ਨ ਸੀ ਉਹ ਅੱਜ ਵੀ ਇਸ ਦੀ ਉਹੀ ਕੰਡੀਸ਼ਨ ਹੈ ਅਤੇ ਇਹ ਬਹੁਤ ਹੀ ਵਧੀਆ ਚੱਲਦੀ ਹੈ ਇਸਦਾ ਪਟਾ ਪਿਓਰ ਚਮੜੇ ਵਾਲਾ ਹੈ ਅਤੇ ਤਿੰਨ ਸਾਲ ਹੋ ਗਏ ਇਸਦੇ ਪਟੇ 'ਤੇ ਇੱਕ ਵੀ ਖਰੋਚ ਜਾਂ ਨਿਸ਼ਾਨ ਨਹੀਂ ਆਇਆ ਹੋਇਆ ਹੈ ਅਤੇ ਜੋ ਇਸਦਾ ਮਿਰਰ ਹੈ ਗਿਲਾਸ ਉਸ 'ਤੇ ਵੀ ਇਕ ਵੀ ਖਰੋਚ ਨਹੀਂ ਆਇਆ ਇਸ ਦਾ ਗਿਲਾਸ ਮਿਰਰ ਬਹੁਤ ਹੀ ਜ਼ਿਆਦਾ ਵਧੀਆ ਹੈ ਇਸ ਵਿੱਚ ਬਹੁਤ ਸਾਰੇ ਫੀਚਰਸ ਹਨ ਜਿਵੇਂ ਕਿ ਬਲੱਡ ਪਰੈਸ਼ਰ ਹਾਰਟ ਬੀਟ ਸੈਂਸਰ ਸਟਾਪ ਵਾਚ ਗੈਲਰੀ ਫੋਟੋਆਂ ਵੀ ਖਿੱਚ ਸਕਦੇ ਮਿਊਜ਼ਿਕ ਵੀ ਸੁਣ ਸਕਦੇ ਅਤੇ ਆਦਿ ਬਹੁਤ ਸਾਰੇ ਇਸ ਵਿੱਚ ਫੀਚਰਸ ਹਨ ਜੋ ਕਿ ਤੁਹਾਨੂੰ ਸਮਾਰਟ ਵਾਚ ਵਿੱਚ ਦੇਖਣ ਨੂੰ ਮਿਲਣਗੇ ਇਹ ਸਮਾਰਟ ਵਾਚ ਘੱਟੋਂ ਘੱਟ ਤਿੰਨ ਸਾਲ ਪਹਿਲਾਂ ਮੈਨੂੰ ਮੇਰੇ ਮਿੱਤਰ ਨੇ ਦਿੱਤੀ ਸੀ ਅਤੇ ਜਿਹੋ ਜਿਹਾ ਕੰਮ ਇਹ ਪਹਿਲਾਂ ਤਿੰਨ ਸਾਲ ਤਿੰਨ ਸਾਲ ਪਹਿਲਾਂ ਕਰਦੀ ਸੀ ਅਤੇ ਹੁਣ ਵੀ ਉਹੋ ਜਿਹਾ ਹੀ ਕੰਮ ਕਰਦੀ ਹੈ ਅਤੇ ਜਿਸ ਨੂੰ ਚਾਰਜ ਕਰੋ ਤਾਂ ਤਿੰਨ ਦਿਨ ਆਰਾਮ ਨਾਲ ਕੱਢ ਜਾਂਦੀ ਹੈ ਬੈਟਰੀ ਪੈਕਅਪ ਬਹੁਤ ਹੀ ਜ਼ਿਆਦਾ ਵਧੀਆ ਹੈ ਅਤੇ ਜੋ ਇਸਦਾ ਪਟਾ ਹੈ ਬਲੈਕ ਪਿਉਰ ਚਮੜੇ 'ਚ ਹੈ ਅਤੇ ਬਹੁਤ ਹੀ ਦੇਖਣ ਨੂੰ ਬਹੁਤ ਹੀ ਸੁੰਦਰ ਲੱਗਦੀ ਹੈ ਅਤੇ ਗੁੱਟ 'ਤੇ ਬੰਨ੍ਹੀ ਹੋਈ ਤਾਂ ਬਹੁਤ ਹੀ ਸੁੰਦਰ ਸੁੰਦਰ ਲੱਗਦੀ ਹੈ ਅਤੇ ਇਹ ਘੜੀ ਮੈਨੂੰ ਸਮਾਂ ਦੇਖਣ ਵਿੱਚ ਬਹੁਤ ਸਹਾਈ ਹੁੰਦੀ ਹੈ ਜਦੋਂ ਕਿਤੇ ਮੈਂ ਖੇਡਣ ਜਾਵਾਂ ਕਿਤੇ ਕੰਮ ਜਾਵਾਂ ਕਿਤੇ ਪੇਪਰ ਦੇਣ ਜਾਵਾਂ ਤਾਂ ਟਾਈਮ ਦੇਖਣ ਵਿੱਚ ਇਹ ਘੜੀ ਮੇਰਾ ਬਹੁਤ ਸਹਾਈ ਹੁੰਦੀ ਹੈ ਇਹ ਘੜੀ ਬਹੁਤ ਹੀ ਸੋਹਣੀ ਹੈ ਦੇ ਦੇਖਣ ਵਿੱਚ ਵੀ ਬਹੁਤ ਸੋਹਣੀ ਲੱਗਦੀ ਹੈ ਅਤੇ ਪਹਿਨਣ ਵਿੱਚ ਵੀ ਬਹੁਤ ਸੋਹਣੀ ਲੱਗਦੀ ਹੈ